ਹੈਲੋ ਸਰ ਮੈਂ ਐਮਾਜੋਨ ਤੋਂ ਇੱਕ ਔਡਰ ਬੁੱਕ ਕਰਵਾਇਆ ਸੀ ਜੋ ਕਿ ਅੱਜ ਆਉਣਾ ਸੀ ਬਟ ਅੱਜ ਨਹੀਂ ਆਇਆ ਅਤੇ ਜਦੋਂ ਆਇਆ ਔਡਰ ਉਹਦੇ ਵਿੱਚ ਜੋ ਅਸੀਂ ਸਲੈਕਟ ਕੀਤਾ ਸੀ ਜੋ ਪਸੰਦ ਕੀਤਾ ਸੀ ਉਹ ਉਹਦੇ ਵਰਗਾ ਬਿਲਕੁਲ ਨਹੀਂ ਸੀ ਇੱਕ ਤਾਂ ਸਾਈਜ਼ ਛੋਟਾ ਸੀ ਅਤੇ ਉਹਦੇ ਵਿੱਚੋਂ ਵੀ ਧਾਗੇ ਨਿਕਲੇ ਹੋਏ ਸੀ ਅਤੇ ਜਿਹੜਾ ਰੰਗ ਅਸੀਂ ਪਸੰਦ ਕੀਤਾ ਸੀ ਉਹ ਵੀ ਰੰਗ ਉਹਦੇ ਨਾਲ ਸੇਮ ਨਹੀਂ ਸੀ ਮੈਚ ਹੀ ਨਹੀਂ ਹੁੰਦਾ ਪਿਆ ਸੀ ਅਤੇ ਉਹਦਾ ਰੰਗ ਵੀ ਬਹੁਤ ਹੀ ਫਿੱਕਾ ਸੀ ਅਤੇ ਜਦੋਂ ਸਾਈਜ਼ ਪਾਇਆ ਇੰਨਾ ਟਾਈਟ ਸੀ ਅਸੀਂ ਸੋਚਿਆ ਸੀ ਚਲੋ ਅਸੀਂ ਫੰਕਸ਼ਨ 'ਤੇ ਉਹਨੂੰ ਜੋ ਮੰਗਵਾਇਆ ਉਹਨੂੰ ਪਾਵਾਂਗੇ ਬਟ ਨਾ ਤਾਂ ਉਹ ਸਾਡੇ ਫੰਕਸ਼ਨ ਲਈ ਸਾਡੇ ਕੰਮ ਆਇਆ ਅਤੇ ਨਾ ਹੀ ਸਾਨੂੰ ਪਸੰਦ ਆਇਆ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲਿਆ ਨਹੀਂ ਉਹਦੀ ਜਿੱਪ ਵੀ ਬਾਹਰ ਨਿਕਲੀ ਹੋਈ ਸੀ ਅਤੇ ਨਾ ਹੀ ਉਹ ਕੱਪੜੇ ਵਿੱਚ ਸ਼ਾਈਨਿੰਗ ਸੀ ਨਾ ਹੀ ਉਹ ਚਮਕਦਾ ਸੀ ਕਿ ਜਿਹੜਾ ਆਪਾਂ ਕਹਿ ਸਕੀਏ ਵੱਟ ਵੀ ਉਹਦੇ ਕੱਪੜੇ 'ਚ ਪੂਰੇ ਸੀ ਬਿਲਕੁਲ ਵੀ ਮੈਨੂੰ ਤੁਹਾਡਾ ਪ੍ਰੋਟੈਕਟ ਨਹੀਂ ਵਧੀਆ ਲੱਗਾ ਮੈਨੂੰ ਬਹੁਤ ਹੀ ਪੁਰਾਣਾ ਲੱਗਿਆ ਸੀ ਇਸ ਕਰਕੇ ਮੇਰਾ ਜਿਹੜਾ ਇਹ ਪ੍ਰੋਜੈਕਟ ਆ ਉਹ ਵਾਪਸ ਕੀਤਾ ਜਾਵੇ